ਮੈਂ ਸਿੱਖ ਧਰਮ ਨਾਲ਼ ਸੰਬੰਧ ਰੱਖਦੀ ਹਾਂ ਅਤੇ ਸਾਡੇ ਧਰਮ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹਨ ਜਿਹੜੀਆਂ ਕਿ ਅੱਜ ਵੀ ਬੜੇ ਮਾਣ ਨਾਲ਼ ਯਾਦ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਸਾਡੇ ਸਿੱਖਾਂ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਵੰਜਾ ਰਾਜਿਆਂ ਨੂੰ ਰਿਹਾਅ ਕਰਵਾ ਕੇ ਲਿਆਏ ਸਨ ਅਤੇ ਜਦੋਂ ਉਹ ਰਿਹਾਅ ਕਰਵਾ ਕੇ ਲਿਆਏ ਸਨ ਤਾਂ ਉਹਨਾਂ ਨੇ ਇੱਕ ਚੋਲਾ ਪਹਿਨਿਆ ਹੋਇਆ ਸੀ ਜਿਨਾਂ ਦੀ ਬਵੰਜਾ ਕਲੀਆਂ ਸਨ ਅਤੇ ਉਹਨਾਂ ਕਲੀਆਂ ਨੂੰ ਫੜ੍ਹ ਕੇ ਹੀ ਬਵੰਜਾ ਰਾਜਿਆਂ ਨੂੰ ਉਸ ਕੈਦ ਚੋਂ ਬਾਹਰ ਕਰਵਾਇਆ ਸੀਗਾ ਅਤੇ ਜਦੋਂ ਗੁਰੂ ਹਰਗੋਬਿੰਦ ਜੀ ਉਸ ਕੈਦ ਤੋਂ ਰਾਜੇ ਨੂੰ ਬਾਹਰ ਕਰਵਾ ਕੇ ਲਿਆਏ ਸੀ ਤਾਂ ਇਸ ਖੁਸ਼ੀ ਵਿੱਚ ਲੋਕਾਂ ਨੇ ਬਹੁਤ ਸਾਰੀ ਦੀਪਮਾਲਾ ਕੀਤੀ ਸੀ ਅਤੇ ਦੀਪਮਾਲਾ ਦੇ ਚਲਦਿਆਂ ਇਸ ਇਸ ਘਟਨਾ ਨੂੰ ਦਿਵਾਲੀ ਦੇ ਰੂਪ ਵਿੱਚ ਸਿੱਖਾਂ ਦੇ ਵਿੱਚ ਅੱਜ ਵੀ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ